ਮੈਂ ਸਵੇਰੇ ਉੱਠ ਕੇ ਵੱਖ ਵੱਖ ਕਿਸਮ ਦਾ ਯੋਗਾ ਕਰਦਾ ਹਾਂ ਮੈਂ ਯੋਗਾ ਦੀਆਂ ਕਿਸਮਾਂ ਬਾਰੇ ਤੁਹਾਡੇ ਨਾਲ ਵਿਚਾਰ ਸਾਂਝਾ ਕਰਨਾ ਚਾਹੁੰਦਾ ਹਾਂ ਯੋਗਾ ਦੀਆਂ ਵੱਖ ਵੱਖ ਸ਼ੈਲੀਆਂ ਦੀ ਪੜਚੋਲ ਕਰਨਾ ਜਿਵੇਂ ਕਿ ਗਰਮ ਯੋਗਾ ਅਤੇ ਏਰੀਅਲ ਯੋਗਾ ਵੱਖ ਵੱਖ ਨਿੱਜੀ ਤਰਜੀਹਾਂ ਅਤੇ ਤੰਦਰੁਸਤੀ ਦੇ ਟੀਚਿਆਂ ਦੇ ਅਨੁਸਾਰ ਵੱਖ ਵੱਖ ਲਾਂਭਾਂ ਦੀ ਪੇਸ਼ਕਸ ਕਰ ਸਕਦਾ ਹੈ ਗਰਮ ਯੋਗਾ ਆਮ ਤੌਰ 'ਤੇ ਲਗਭਗ ਪੈਂਤੀ ਤੋਂ ਚਾਲੀ ਡਿਗਰੀ ਸੈਲਸੀਅਸ ਤੱਕ ਗਰਮ ਕਮਰੇ ਗਰਮ ਕੀਤੇ ਕਮਰੇ ਵਿੱਚ ਅਭਿਆਸ ਕੀਤਾ ਜਾਂਦਾ ਹੈ ਦਿਲ ਦੀ ਧੜਕਣ ਨੂੰ ਵਧਾ ਕੇ ਅਤੇ ਪਸੀਨੇ ਨੂੰ ਵਧਾ ਕੇ ਰਿਵਾਇਤੀ ਯੋਗਾ ਅਭਿਆਸ ਨੂੰ ਤੇਜ਼ ਕਰਦਾ ਹੈ ਜੋ ਕੇ ਕਾਰਡੀਓ ਵੈਸਕੂਲਰ ਤੰਦਰੁਸਤੀ ਨੂੰ ਵਧਾ ਸਕਦਾ ਹੈ ਸਰੀਰ ਨੂੰ ਡਿਟੋਕਸ ਕਰ ਸਕਦਾ ਹੈ ਅਤੇ ਉਹ ਸੁਧਾਰ ਕਰ ਸਕਦਾ ਹੈ ਲਚਕਤਾ ਗਰਮੀ ਮਾਸਪੇਸ਼ੀਆਂ ਅਤੇ ਜੋੜਾਂ ਨੂੰ ਢਿੱਲੀ ਕਰਨ ਵਿੱਚ ਮਦਦ ਕਰਦਾ ਹੀ ਹੈ ਜਿਸ ਨਾਲ ਡੂੰਘੇ ਬਚਾਅ ਹੁੰਦੇ ਹਨ ਸੁਭਾਵਿਕ ਤੌਰ 'ਤੇ ਸੱਟ ਲੱਗਣ ਦੇ ਜੋਖਮ ਨੂੰ ਘਟਾਉਂਦੇ ਹਨ ਇਸ ਤੋਂ ਇਲਾਵਾ ਚੁਣੌਤੀ ਪੂਰਨ ਵਾਤਾਵਰਨ ਮਾਨਸਿਕ ਕਠੋਰਤਾ ਅਤੇ ਫੋਕਸ ਨੂੰ ਉਤਸ਼ਾਹ ਕਰਦਾ ਹੈ ਕਿਉਂਕਿ ਪਰੈਕਟੀਸ਼ੀਨਰ ਗਰਮੀ ਦੇ ਅਨੁਕੂਲ ਹੁੰਦੇ ਹਨ ਇਸ ਦੇ ਉਲਟ ਏਰੀਅਲ ਯੋਗਾ ਸਰੀਰ ਨੂੰ ਸਮਰਥਨ ਦੇਣ ਲਈ ਇੱਕ ਮੁਅੱਤਲ ਹੈਮੌਕ ਜਾਂ ਰੇਸ਼ਮ ਦੀ ਵਰਤੋਂ ਕਰਦਾ ਹੈ ਜਿਸ ਨਾਲ ਪ੍ਰੈਕਟੀਸ਼ੀਨਰਾਂ ਨੂੰ ਵਾਧੂ ਸਮਰਥਨ ਲਾਭ ਨਾਲ ਰਿਵਾਇਤੀ ਪੋਜ ਕਰਨ ਦੀ ਇਜਾਜ਼ਤ ਮਿਲਦੀ ਹੈ ਇਹ ਸ਼ੈਲੀ ਹੈਮੌਕ ਨੂੰ ਕੁਛਨਿੰਗ ਪ੍ਰਭਾਵ ਕਾਰਨ ਜੋੜਾਂ ਅਤੇ ਮਾਸਪੇਸ਼ੀਆਂ ਦਬਾਅ ਨੂੰ ਘਟਾਉਂਦੇ ਹੋਏ ਕੌਰ ਤਾਕਤ ਸੰਤੁਲਨ ਲਚਕਤਾ ਨੂੰ ਸੁਧਾਰ ਕਰਦੀ ਹੈ ਇਹ ਭਾਰ ਰਹਿਤ ਹੋਣ ਦੀ ਇੱਕ ਵਿਲੱਖਣ ਭਾਵਨਾ ਦੀ ਪੇਸ਼ਕਸ਼ ਵੀ ਕਰਦਾ ਹੈ ਜਿਸ ਨਾਲ ਡੂੰਘੀਆਂ ਖਿੱਚਾਂ ਅਤੇ ਉਲਟੀਆਂ ਨੂੰ ਪ੍ਰਾਪਤ ਕਰਨਾ ਆਸਾਨ ਹੋ ਜਾਂਦਾ ਹੈ ਦੋਵੇਂ ਸਟੈਲ ਪਹੁੰਚ ਵਿੱਚ ਵੱਖੋ ਵੱਖ ਹੋਣ ਦੇ ਬਾਵਜੂਦ ਨਵੀਆਂ ਚੁਣੌਤੀਆਂ ਦੀ ਪੇਸ਼ਕਸ ਕਰਕੇ ਸਰੀਰਕ ਸਮਰੱਥਾ ਨੂੰ ਵਧਾ ਕੇ ਅਤੇ ਸਰੀਰ ਦੇ ਨਾਲ ਇੱਕ ਡੂੰਘੇ ਸੰਬੰਧ ਨੂੰ ਉਤਸ਼ਾਹ ਕਰਕੇ ਅੰਤ ਵਿੱਚ ਸਮੁੱਚੇ ਯੋਗਾ ਅਨੁਭਵ ਨੂੰ ਅਮੀਰ ਬਣਾਉਂਦੇ ਹੋਏ ਅਤੇ ਵੱਧ ਤੋਂ ਵੱਧ ਸਮੁੱਚੀ ਤੰਦਰੁਸਤੀ ਨੂੰ ਉਤਸ਼ਾਹ ਕਰਕੇ ਇੱਕ ਚੰਗੀ ਤਰ੍ਹਾਂ ਯੋਗ ਅਭਿਆਸ ਵਿੱਚ ਯੋਗਦਾਨ ਪਾਉਂਦੇ ਹਨ